ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਕਰਮਵੀਰ ਜੀ ਹਾਂਜੀ ਹਾਂਜੀ ਜਗਜੀਤ ਬੋਲਦਾ ਜੀ ਹਾਂਜੀ ਵਧੀਆ ਠੀਕ ਜੇ ਹਾਂਜੀ ਹਰੀ ਕ੍ਰਾਂਤੀ ਸਰਕਾਰ ਨੇ ਲੈ ਆਂਦੀ ਹੈ ਕਿ ਪੂਰੀ ਫੁੱਲ ਚੱਲਦੀ ਆ ਅਰੇ ਹਰੀ ਕ੍ਰਾਂਤੀ ਦਾ ਰਿਜਲਟ ਤੁਹਾਡੇ ਸਾਹਮਣੇ ਹੀ ਆ ਵੀ ਫਾਇਦੇ ਵੀ ਚਲੋ ਇਹਦੇ ਹੋਏ ਆ ਅਤੇ ਨੁਕਸਾਨ ਹੁਣ ਆਣ ਕੇ ਹੋਣ ਡਏ ਆ ਹਾਂਜੀ ਦੇਖੋ ਇਹ ਪੰਜਾਬ ਪੰਜਾਬ ਯੂਨੀਵਰ ਪੰਜਾਬ ਯੂਨੀਵਰਸਿਟੀ ਨੇ ਵੀ ਇਹ ਟੋਪਿਕ 'ਤੇ ਬੜਾ ਕੰਮ ਕੀਤਾ ਹਰੀ ਕ੍ਰਾਂਤੀ 'ਤੇ ਚਲੋ ਸਾਰੇ ਦੇਸ਼ ਹਾਂ ਸਾਰੇ ਦੇਸ਼ ਦਾ ਢਿੱਡ ਭਰਨ ਵਾਸਤੇ ਚਲੋ ਹਰੀ ਕ੍ਰਾਂਤੀ ਜ਼ਰੂਰੀ ਵੀ ਸੀ ਪਰ ਹੁਣ ਇਹਦੇ ਮਾੜੇ ਸਿੱਟੇ ਨਿਕਲ ਰਹੇ ਆ ਦਵਾਈਆਂ ਬਹੁਤ ਜ਼ਿਆਦਾ ਵਧਾ ਛੱਡੀਆਂ ਦਵਾਈਆਂ ਖਾਦਾਂ ਲੋਕ ਚਲੋ ਲੋਕਾਂ 'ਚ ਵੀ ਅਗਿਆਨਤਾ ਵਾ ਜਿਹਨੇ ਐਰਕਾ ਇੱਕ ਨੇ ਚਾਰ ਪਈਆਂ ਅਗਲੇ ਦੂਜੇ ਨੇ ਪੰਜ ਪੂਰੀਆਂ ਪਾ ਦਿਤੀਆਂ ਯੂਰੀਆ ਦੀਆਂ ਅਤੇ ਪਾਣੀ ਵੀ ਚਲੋ ਪਾਣੀ ਵੀ ਦੂਸ਼ਿਤ ਹੋਣ ਡਿਆ ਵਾ ਅਤੇ ਮਿੱਟੀ ਵੀ ਥੋੜ੍ਹੀ ਬੰਜਰ ਹੁੰਦੀ ਜਾਂਦੀ ਆ ਹਾਂਜੀ ਹਾਂਜੀ ਚਲੋ ਹਾਂ ਕੁਝ ਤਾਂ ਚਲੋ ਫ਼ਾਇਦਾ ਆ ਕੁਝ ਨੁਕਸਾਨ ਵੀ ਹੋਇਆ ਤਾਂ ਦੂਜੀ ਗੱਲ ਵੀ ਹੁਣ ਬਿਮਾਰੀਆਂ ਕੈਂਸਰ ਵਰਗੀਆਂ ਪੰਜਾਬ ਨੂੰ ਹਰੀ ਕ੍ਰਾਂਤੀ ਦੀ ਦੇਣ ਆ ਨਹੀਂ ਨਹੀਂ ਇਹ ਤਾਂ ਥੋੜ੍ਹੀ ਜਿਹੀ ਆਪਣੇ ਵੀ ਨਾਸਮਝੀ ਆ ਆਪਾਂ ਅ ਇੱਕ ਦੂਜੇ ਤੋਂ ਵੱਧ ਕੇ ਪਾਈ ਜਾਂਦੇ ਹਾਂ ਜਿਹੜੀ ਚੀਜ਼ ਦੀ ਜ਼ਰੂਰਤ ਨਹੀਂ ਆ ਉਹ ਸਪਰੇਹਾਂ ਕਰੀ ਜਾਂਦੇ ਹਾਂ ਥੋੜ੍ਹਾ ਜਿਹਾ ਸੋਚ ਸਮਝ ਕੇ ਕਰਾਂਗੇ ਤਾਂ ਹਰੀ ਕ੍ਰਾਂਤੀ ਦਾ ਫ਼ਾਇਦਾ ਹੈ ਹੋਰ ਠੀਕ ਠਾਕ ਜੇ ਚਲੋ ਠੀਕ ਹੈ ਜੀ ਠੀਕ ਓਕੇ